ਮੇਰਾ ਪਰਿਵਾਰਕ ਮਾਹੌਲ ਖੇਤੀਬਾੜੀ ਨਾਲ਼ ਸੰਬੰਧਿਤ ਹੋਣ ਕਰਕੇ ਮੈਨੂੰ ਬਾਗਬਾਨੀ ਵਿੱਚ ਸ਼ੁਰੂ ਤੋਂ ਹੀ ਸ਼ੌਕ ਰਿਹਾ ਹੈ ਪਰੰਤੂ ਜਦੋਂ ਜਿਸ ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ ਤਾਂ ਉਸ ਟਾਈਮ ਤੋਂ ਮੇਰੇ ਪਰਿਵਾਰ ਦੇ ਵਿੱਚ ਮੇਰੇ ਪਿਤਾ ਜੀ ਅਤੇ ਮਾਤਾ ਜੀ ਬਾਗਬਾਨੀ ਦਾ ਹੀ ਕੰਮ ਕਰਦੇ ਸੀ ਅਤੇ ਖੇਤੀਬਾੜੀ ਦਾ ਕੰਮ ਕਰਦੇ ਸੀ ਇਸ ਕਰਕੇ ਮੇਰਾ ਰੁਝਾਨ ਉੱਥੋਂ ਸ਼ੁਰੂ ਤੋਂ ਬਣਿਆ ਅਤੇ ਅਗਰ ਮੈਂ ਗੱਲ ਕਰਾਂ ਕਿ ਕਦੋਂ ਤੋਂ ਸ਼ੁਰੂ ਕੀਤੀ ਤਾਂ ਇਸ ਸੰਬੰਧ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਪਹਿਲਾਂ ਮੈਂ ਆਪਣੇ ਪਿੰਡ ਦੇ ਵਿੱਚ ਆਪਣੇ ਮਾਤਾ ਪਿਤਾ ਨਾਲ਼ ਰਹਿੰਦਾ ਸੀ ਅਤੇ ਉਹਨਾਂ ਦੇ ਨਾਲ਼ ਬਾਗਬਾਨੀ ਦੇ ਕੰਮ ਦੇ ਵਿੱਚ ਉਹਨਾਂ ਦੀ ਮਦਦ ਕਰਦਾ ਸੀ ਪਰੰਤੂ ਜਦੋਂ ਮੈਂ ਸਰਵਿਸ ਦੇ ਵਿੱਚ ਆਇਆ ਮੇਰੀ ਵੱਖ ਵੱਖ ਸ਼ਹਿਰਾਂ ਦੇ ਵਿੱਚ ਮੇਰੀ ਨੌਕਰੀ ਦੇ ਦੌਰਾਨ ਮੇਰੀ ਪੋਸਟਿੰਗ ਹੋਈ ਤਾਂ ਜਿਸ ਤਰ੍ਹਾਂ ਕਿ ਦੋ ਹਜ਼ਾਰ ਚੌਦਾਂ ਵਿੱਚ ਸੁਲਤਾਨਪੁਰ ਲੋਧੀ ਕਸਬੇ ਦੇ ਵਿੱਚ ਮੇਰਾ ਮੇਰੀ ਪਹਿਲੀ ਪੋਸਟਿੰਗ ਹੋਈ ਤਾਂ ਉੱਥੇ ਮੈਂ ਘਰ ਦੇ ਵਿੱਚ ਹੀ ਕਹੀ ਦੇ ਨਾਲ਼ ਮਿੱਟੀ ਦੀ ਖੁਦਾਈ ਕਰਕੇ ਅਤੇ ਗਰਮੀਆਂ ਦੀਆਂ ਵੱਖ ਵੱਖ ਸਬਜ਼ੀਆਂ ਅਤੇ ਸਰਦੀਆਂ ਦੀਆਂ ਵੱਖ ਵੱਖ ਸਬਜ਼ੀਆਂ ਦੀ ਉਪਜ ਉੱਥੇ ਪੈਦਾ ਕਰਦਾ ਸੀ ਇਸ ਸੰਬੰਧ ਵਿੱਚ ਮੇਰੀ ਧਰਮ ਪਤਨੀ ਵੀ ਮੇਰੀ ਬਹੁਤ ਹੈਲਪ ਕਰਦੀ ਸੀ ਅਤੇ ਉਸ ਤੋਂ ਬਾਅਦ ਜਦੋਂ ਮੇਰੀ ਪੋਸਟਿੰਗ ਅੰਮ੍ਰਿਤਸਰ ਵਿਖੇ ਹੋਈ ਇੱਥੇ ਮੈਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿੱਚ ਰਹਿਣ ਦਾ ਮੌਕਾ ਮਿਲਿਆ ਅਤੇ ਇੱਥੇ ਬਹੁਤ ਥਾਂ ਅਵੇਲੇਬਲ ਹੈ ਇਹ ਤੁਹਾਡੇ ਆਪਣੇ 'ਤੇ ਹੈ ਕਿ ਤੁਸੀਂ ਇਸ ਸਥਾਨ ਨੂੰ ਕਿਵੇਂ ਡਿਵੈਲਪ ਕਰ ਸਕਦੇ ਹੋ ਇਸ ਸਥਾਨ ਨੂੰ ਕਿਵੇਂ ਪੱਧਰਾ ਕਰ ਕੇ ਸਬਜ਼ੀਆਂ ਦੇ ਲਈ ਪ ਮਤਲਬ ਵਰਤ ਸਕਦੇ ਹੋ ਤਾਂ ਇੱਥੇ ਕਿਉਂਕਿ ਮੈਨੂੰ ਖੁੱਲ੍ਹਾ ਥਾਂ ਮਿਲ ਗਿਆ ਅਤੇ ਪਾਣੀ ਦੀ ਵੀ ਕੋਈ ਇੱਥੇ ਪ੍ਰੋਬਲਮ ਨਹੀਂ ਸੀ ਪਾਣੀ ਕਾਫ਼ੀ ਚੰਗੀ ਮਾਤਰਾ ਵਿੱਚ ਇੱਥੇ ਉਪਲਬਧ ਹੈਗਾ ਸੀ ਅਤੇ ਇਸ ਲਈ ਮੈਂ ਇਸ ਯੂਨੀਵਰਸਿਟੀ ਦੇ ਕੈਂਪਸ ਵਿਖੇ ਵੀ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਜੀ ਧੰਨਵਾਦ ਜੀ